ਹੋਰ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਨੇ ਜੀ ਹੋਰ ਕੀ ਕਰਦੇ ਹੋ ਅਤੇ ਮੈਂ ਵੀ ਵਧੀਆ ਹੈ ਅਤੇ ਮੈਂ ਤੁਹਾਨੂੰ ਇਹੀ ਕਹਿਣ ਲਈ ਕੀਤਾ ਕਿ ਸਾਡਾ ਜਿਵੇਂ ਪਿਛਲੇ ਦੋ ਵਾਰ ਦਾ ਵੀਕਐਂਡ ਦਾ ਜਿਹੜਾ ਪ੍ਰੋਗਰਾਮ ਫਿਲਮ ਦੇਖਣ ਦਾ ਜਿਹੜਾ ਕੈਂਸਲ ਹੁੰਦਾ ਰਿਹਾ ਸੀ ਅਤੇ ਹੁਣ ਮੈਂ ਅਗਲੇ ਵੀਕਐਂਡ ਦਾ ਜਿਹੜਾ ਬਣਾ ਰਿਹਾ ਸੀ ਤਾਂ ਹੀ ਤੁਹਾਨੂੰ ਇਸ ਵਿੱਚ ਫੋਨ ਕੀਤਾ ਅਤੇ ਮੈਨੂੰ ਸਮਝ ਵੀ ਨਹੀਂ ਆ ਰਹੀ ਸੀ ਕਿ ਮੈਂ ਕੀ ਕਹਿਣਾ ਕਿ ਸਾਡੇ ਸਮਾਜ ਥੇਟਰ ਵਿੱਚ ਬਹੁਤ ਹੀ ਵਧੀਆ ਇਤਿਹਾਸਿਕ ਆਪਣੀਆਂ ਜਿਹੜੀਆਂ ਫਿਲਮਾਂ ਲੱਗੀਆਂ ਹੋਈਆਂ ਨਾ ਅਤੇ ਤੁਹਾਡੇ ਨਾਲ ਇਹ ਜਿਹੜਾ ਮੇਰਾ ਪਲੈਨ ਜਿਹੜਾ ਫੈਮਿਲੀ ਪ ਪਲੈਨ ਬਣਾਇਆ ਤੁਹਾਡੀ ਫੈਮਲੀ ਅਤੇ ਮੇਰੀ ਫੈਮਿਲੀ ਦੋਨੇ ਜਿਹੜੇ ਹੈ ਕਿ ਜਾਣ ਵਾਲੇ ਇਸ ਨਾਲ ਸਾਡਾ ਜਿਹੜਾ ਪਰਿਵਾਰਿਕ ਪਿਆਰ ਵੀ ਜਿਹੜਾ ਵੱਧ ਜਾਵੇ ਇਸ ਕਰਕੇ ਮੈਂ ਤੁਹਾਡੇ ਨਾਲ ਇਹੀ ਕਹਿਣਾ ਚਾਹੁੰਦਾ ਤਾਂ ਕਿ ਅਸੀਂ ਕਿਵੇਂ ਜਿਹੜੀ ਫਿਲਮ ਦੇਖੀ ਤੁਹਾਡੇ ਸਾਹਮਣੇ ਜਿੱਦਾਂ ਦੋ ਜਿਹੜੀਆਂ ਇਤਿਹਾਸਿਕ ਸਾਡੀਆਂ ਫਿਲਮਾਂ ਲੱਗੀਆਂ ਹੋਈਆਂ ਹਨ ਅਤੇ ਅਸੀਂ ਵੀ ਚਾਹੁੰਦੇ ਕਿ ਫੈਮਿਲੀ ਬੱਚੇ ਵੀ ਹੈ ਅਤੇ ਬੱਚਿਆਂ ਦੇ ਨਾਲ ਫੈਮਿਲੀ ਦੇ ਨਾਲ ਦੇਖਣਯੋਗ ਫਿਲਮਾਂ ਉਹੀ ਹੋਣੀ ਚਾਹੀਦੀ ਹੈ ਅਤੇ ਤੁਸੀਂ ਮੈਨੂੰ ਆਪਣਾ ਦੱਸ ਦਿਓ ਕਿ ਜਿਵੇਂ ਕਰਨੀ ਹੈ ਤੁਸੀਂ ਜਿਵੇਂ ਹੀ ਅਗਲੇ ਹਫਤੇ ਜਿਵੇਂ ਫ੍ਰੀ ਹੋ ਤਾਂ ਤੁਸੀਂ ਮੈਨੂੰ ਦੱਸ ਦਿਓ ਤੁਸੀਂ ਕਿੰਨੇ ਜਣੇ ਹੈਗੇ ਐ ਅਤੇ ਅਸੀਂ ਕਰ ਕਰ ਟਿਕਟਾਂ ਕੰਫਰਮ ਪਹਿਲਾਂ ਕਰਕੇ ਜਿਵੇਂ ਕਿ ਪਿਛਲੀ ਵਾ ਵਾਰ ਵਾਂਗੂੰ ਕੈਂਸਲ ਪ੍ਰੋਗਰਾਮ ਨਾ ਹੋ ਜਾਵੇ ਇਸ ਕਰਕੇ ਅਸੀਂ ਪਹਿਲਾਂ ਹੀ ਆਪਣੀ ਪਲੈਨਿੰਗ ਜਿਹੜੀ ਹੈ ਸੇਫ ਰੱਖਣੀ ਹੈ ਅਤੇ ਰੋਟੀ ਪਾਣੀ ਦਾ ਵੀ ਅਸੀਂ ਜਿਹੜਾ ਕੰਮ ਜਿਹੜਾ ਬਾਹਰ ਹੀ ਕਰਲਾਂਗੇ ਜਿਸ ਨਾਲ ਹੋਰ ਜ਼ਿਆਦਾ ਫੈਮਿਲੀ ਟਾਈਮ ਸਪੈਂਡ ਹੋਜੂੰਗਾ ਅਤੇ ਇੱਕ ਸਾਡੀ ਪਰਿਵਾਰ ਦਾ ਜਿਹੜਾ ਆਪਸੀ ਪਿਆਰ ਤਾਲਮੇਲ ਵੀ ਵੱਧ ਜਾਏਗਾ ਅਤੇ ਜਿਸ ਨਾਲ ਅਸੀਂ ਇੱਕ ਹੋਰ ਇੱਕ ਦੂਜੇ ਨੇੜੇ ਵੀ ਮਹਿਸੂਸ ਕਰਾਂਗੇ ਅਤੇ ਤੁਸੀਂ ਮੈਨੂੰ ਆਪਣਾ ਭਾਅ ਜੀ ਦੱਸ ਦਿਓ ਕਿਵੇਂ ਤੁਸੀਂ ਜਿਸ ਦਿਨ ਫ੍ਰੀ ਹੋ ਅਤੇ ਕਿਹੜੀ ਦੀ ਫਿਲਮ ਦੇਖਣਾ ਚਾਹੁੰਦੇ ਹੋ ਅਤੇ ਜਿਸ ਨਾਲ ਸਾਡੇ ਬੱਚਿਆਂ ਨੂੰ ਵੀ ਅਤੇ ਅਤੇ ਸਾਡੇ ਪਰਿਵਾਰਾਂ ਦੋਨਾਂ ਪਰਿਵਾਰਾਂ ਨੂੰ ਪਤਾ ਇਤਿਹਾਸ ਬਾਰੇ ਵੀ ਪਤਾ ਲੱਗੇ ਅਤੇ ਇੱਕ ਸਾਥ ਰਹਿਣ ਦੀ ਕੀ ਤਾਕਤ ਹੁੰਦੀ ਹੈ ਸਾਥ ਰਹਿਣ ਨਾਲ ਕੀ ਕਿਹੜੀਆ ਕਿਹੜੀਆਂ ਮੁਸ਼ਕਿਲਾਂ ਦਾ ਹੱਲ ਵੀ ਹੋ ਜਾਂਦਾ ਹੈ ਇਸ ਨਾਲ ਸਾਡਾ ਜਿਹੜਾ ਕਿ ਆਪਣੇ ਇਤਿਹਾਸ ਤੋਂ ਅਤੇ ਆਪਣੇ ਪਿਛੋਕੜ ਤੋਂ ਆਪਣੇ ਵਿਰਸੇ ਨੂੰ ਨਾ ਭੁੱਲੀਏ ਅਤੇ ਮੈਂ ਤੁਹਾਡਾ ਮੈਨੂੰ ਤੁਹਾਡੇ ਜਵਾਬ ਦਾ ਇੰਤਜ਼ਾਰ ਰਹੇਗਾ ਜੀ ਅਤੇ ਮੈਨੂੰ ਛੇਤੀ ਛੇਤੀ ਦੱਸ ਦਿਓ ਕਿਉਂਕਿ ਤੁਸੀਂ ਵੀ ਬਿਜੀ ਹੁੰਦੇ ਅਤੇ ਆਪਾਂ ਵੀ ਉਹ ਅਤੇ ਅਗਲੇ ਹਫਤੇ ਜਿੱਦਾਂ ਵੀ ਹੋ ਸਕਿਆ ਤੁਸੀਂ ਮੈਨੂੰ ਦੱਸ ਦਿਓ ਅਤੇ ਅਸੀਂ ਜਿਹੜੇ ਐ ਦੋਨੇ ਪਰਿਵਾਰ ਮਿਲ ਕੇ ਫਿਲਮ ਦੇਖਣ ਜਾਵਾਂਗੇ ਚਲੋ ਠੀਕ ਆ ਬਾਈ ਜੀ ਮਿਲਦੇ ਆ ਫਿਰ ਧੰਨਵਾਦ